ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਵੱਖ ਵੱਖ ਥਾਵਾਂ 'ਤੇ ਅਲੱਗ ਅਲੱਗ ਜਿਹੜੀ ਪੁਸ਼ਾਕ ਹੈ ਉਹਦੀ ਵਰਤੋਂ ਕੀਤੀ ਜਾਂਦੀ ਹੈ ਚੜ੍ਹਦੇ ਪੰਜਾਬ ਵਿੱਚ ਇਸ ਦਾ ਅਲਾ ਅਲੱਗ ਰੁਤਬਾ ਹੈ ਅਤੇ ਲਹਿੰਦੇ ਪੰਜਾਬ ਇਸ ਦਾ ਅਲੱਗ ਰੁਤਬਾ ਹੈ ਆਪਾਂ ਅ ਗੱਲ ਕਰਾਂਗੇ ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਕੀ ਕੀ ਪਹਿਨਿਆਂ ਜਾਂਦਾ ਹੈ ਸਭ ਤੋਂ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਤੰਬਾ ਦੀ ਜਿਸ ਨੂੰ ਤਹਿਮਤ ਵੀ ਕਿਹਾ ਜਾਂਦਾ ਹੈ ਲੂੰਗੀ ਦਾ ਪੰਜਾਬੀ ਸੰਸਕਰਣ ਹੈ ਜਿਸਦਾ ਅੱਗੇ ਮੋੜ ਹੁੰਦਾ ਹੈ ਅਤੇ ਪੰਜਾਬੀ ਮਰਦਾਂ ਲਈ ਰਵਾਇਤੀ ਪਹਿਰਾਵਾ ਹੈ ਤੰਬਾ ਭੰਗੜਾ ਡਾਂਸਰਾ ਦੁਆਰਾ ਪਹਿਨਿਆ ਜਾਂਦਾ ਹੈ ਹਾਲ ਹੀ ਦੇ ਸਾਲਾਂ ਵਿੱਚ ਪੂਰਵੀ ਪੰਜਾਬ ਵਿੱਚ ਪੰਜਾਬੀ ਤਹਿਮਤ ਦੀ ਵਰਤੋਂ 'ਚ ਗਿਰਾਵਟ ਆਈ ਹੈ ਜਿਸ ਦੀ ਥਾਂ ਪਜਾਮੇ ਨੇ ਲੈ ਲਈ ਹੈ ਮਰਦਾਂ ਨੂੰ ਤਹਿਮਤ ਪਹਿਨਦੇ ਦੇਖਿਆ ਜਾ ਸਕਦਾ ਹੈ ਇਸ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਨਹੀਂ ਹੋਈ ਹੈ ਪਛੱਮੀ ਪੰਜਾਬ ਅਤੇ ਨਾਲ ਨਾਲ ਲੱਗਦੇ ਹਜ਼ਾਰਾਂ ਪਾਕਿਸਤਾਨ ਅਤੇ ਪੰਜਾਬੀ ਮਰਦਾਂ 'ਤੇ ਵੀ ਤੰਬਾ ਜਾਂ ਲੂੰਗੀ ਦੇਖਿਆ ਜਾ ਸਕਦਾ ਹੈ ਤਹਿਮਤ ਇੱਕ ਰੰਗ ਦੀ ਹੁੰਦੀ ਹੈ ਅਤੇ ਇਸਦੀ ਕੋਈ ਸਰਹੱਦ ਨਹੀਂ ਹੁੰਦੀ ਤਹਿਮਤ ਜਾਂ ਲਾਚਾ ਅੱਡੀ ਤੱਕ ਲੰਬਾ ਹੋ ਸਕਦਾ ਹੈ ਇਹ ਗੋਡਿਆਂ ਦੇ ਬਿਲਕੁਲ ਹੇਠਾਂ ਤੱਕ ਵੀ ਛੋਟਾ ਹੋ ਸਕਦਾ ਹੈ ਇੱਕ ਲਾਚਾ ਤਹਿਮਤ ਨਾਲੋਂ ਵੱਖਰਾ ਹੁੰਦਾ ਹੈ ਕਿਉਂਕਿ ਇਸ ਦੀ ਇੱਕ ਕਿਨਾਰੀ ਹੁੰਦੀ ਹੈ ਅਤੇ ਭਿੰਨ ਭਿੰਨ ਹੁੰਦਾ ਹੈ ਤਾਂ ਜੋ ਇਸਦੇ ਇੱਕ ਤੋਂ ਵੱਧ ਰੰਗ ਹੁੰਦੇ ਹਨ ਲਾਚਾ ਪੱਛਮੀ ਪੰਜਾਬ ਵਿੱਚ ਪ੍ਰਸਿੱਧ ਹੈ ਲਾਚਾ ਤਹਿਮਤ ਵਾਂਗ ਹੀ ਪਹਿਨਿਆ ਜਾਂਦਾ ਹੈ ਸਿਵਾਏ ਇਸ ਵਿੱਚੋਂ ਹੋਰ ਫੋਲਡ ਹੁੰਦੇ ਹਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਔਰਤਾਂ ਤਹਿਮਤ ਅਤੇ ਲਾਚਾ ਪਹਿਨਦੀਆਂ ਹਨ ਖਾਸ ਕਰਕੇ ਗੁਜਰਾਤ ਦੇ ਜ਼ਿਲ੍ਹਿਆਂ ਵਿੱਚ ਜਿਵੇਂ ਗੁਜਰਾਂਵਾਲਾ ਸ਼ਾਹਪੁਰਾ ਅਤੇ ਮੁਜੱਫਰ ਵਿੱਚ ਅਤੇ ਲ ਚੜ੍ਹਦੇ ਪੰਜਾਬ ਵਿੱਚ ਇਸ ਨੂੰ ਅਸੀਂ ਪੋਸ਼ਾਕ ਭੰਗੜੇ ਦੀ ਪੋਸ਼ਾਕ ਲਈ ਖਾਸ ਯੂਜ ਕਰਦੇ ਹਾਂ ਜਿਸ ਵਿੱਚ ਭੰਗੜੇ ਦਾ ਜਦੋਂ ਕੋਈ ਭੰਗੜਾ ਪਾਉਂਦਾ ਹੈ ਜਾਂ ਭੰਗੜਾ ਕਰਦਾ ਹੈ ਉਸ ਨੂੰ ਕੰਫਰਟੇਬਲ ਫੀਲ ਹੁੰਦਾ ਹੈ ਜਿਸ ਕਰਕੇ ਉਹ ਆਪਣਾ ਜਿਹੜਾ ਲੋਕ ਨਾਚ ਹੈ ਉਹ ਲੋਕਾਂ ਅੱਗੇ ਇੱਕ ਖੁੱਲੇ ਮਨ ਨਾਲ ਇੱਕ ਖੁੱਲ੍ਹੇ ਦਿਲ ਦੇ ਨਾਲ ਲੋਕਾਂ ਅੱਗੇ ਰੱਖਦਾ ਹੈ ਜਿਸ ਕਰਕੇ ਉਸ ਦੀ ਜਿਹੜੀ ਪ੍ਰਦਰਸ਼ਨ ਵਿੱਚ ਨਿਖਾਰ ਆਉਂਦਾ ਹੈ ਅਤੇ ਇਸ ਦੇ ਨਾਲ ਨਾਲੋਂ ਇੱਕ ਵਿਲੱਖਣ ਤੁਰਲੇ ਵਾਲੀ ਪੱਗ ਵੀ ਬੰਨੀ ਜਾਂਦੀ ਹੈ ਜੋ ਭੰਗੜੇ ਅਤੇ ਹਾਰ ਜਾਂ ਉਹਨੂੰ ਹੋਰ ਨਿਖਾਰਦੀ ਹੈ ਇਸ ਦੇ ਨਾਲ ਪੰਜਾਬੀ ਨੌਜਵਾਨ ਪੰਜਾਬੀ ਜੁੱਤੀ ਅਤੇ ਕੈਂਠੇ ਦੀ ਵਰਤੋਂ ਵੀ ਕਰਦੇ ਹਨ